ਪੰਜਾਬ ਦੇ ਸਥਾਨਕ ਭੋਜਨ ਖਾਣ ਲਈ ਮੈਨੂੰ ਅੰਮ੍ਰਿਤਸਰ ਬਹੁਤ ਪਸੰਦ ਹੈ ਅੰਮ੍ਰਿਤਸਰ ਦੇ ਜਿਹੜੇ ਕੁਲਚੇ ਛੋਲੇ ਹੁੰਦੇ ਆ ਉਹ ਬੜੇ ਹੀ ਚੰਗੇ ਲੱਗਦੇ ਹੈ ਤਾਂ ਅੰਮ੍ਰਿਤਸਰ ਦੀਆਂ ਤੁਸੀਂ ਦੇਖੋ ਗਲੀਆਂ ਦੇ ਵਿੱਚ ਹਰ ਇੱਕ ਬਹੁਤ ਰੇੜੀਆਂ ਹੁੰਦੀਆਂ ਜਿੱਥੇ ਕਿ ਥਾਂ ਥਾਂ 'ਤੇ ਕੁਲਚੇ ਛੋਲੇ ਮਿਲਦੇ ਹੈ ਇਸੇ ਤਰ੍ਹਾਂ ਹੀ ਜੇ ਤੁਸੀਂ ਹੋਰ ਦੂਜੇ ਸ਼ਹਿਰ ਦੇ ਵਿੱਚ ਚਲੇ ਜਾਓ ਜਿਸ ਤਰ੍ਹਾਂ ਪਟਿਆਲੇ ਦੇ ਵਿੱਚ ਆ ਜੀਏ ਪਟਿਆਲੇ ਦੇ ਵਿੱਚ ਬਰੈਡ ਵਾਲੇ ਕੁਲਚੇ ਛੋਲੇ ਉਹ ਬਹੁਤ ਮਸ਼ਹੂਰ ਹੈ ਜਿਹੜੇ ਅੰਮ੍ਰਿਤਸਰ ਦੇ ਆ ਉਹ ਤਾਂ ਤੰਦੂਰੀ ਕੁਲਚੇ ਬਣਾਉਂਦੇ ਜਿਸ ਤਰ੍ਹਾਂ ਆਪਾਂ ਪਰੌਂਠੇ ਟਾਈਪ 'ਤੇ ਬਣਾਉਂਦੇ ਹਾਂ ਪਰ ਪਟਿਆਲੇ ਦੇ ਵਿੱਚ ਬਰੈਡ ਦੇ ਕੁਲਚੇ ਅਤੇ ਛੋਲੇ ਇਹ ਬਹੁਤ ਮਸ਼ਹੂਰ ਹੈ ਇੱਕ ਪਟਿਆਲੇ ਦੇ ਵਿੱਚ ਜਿਵੇਂ ਆ ਗਿਆ ਸਿੰਘ ਦਾ ਢਾਬਾ ਇਹ ਵੀ ਬਹੁਤ ਮਸ਼ਹੂਰ ਹੈ ਜਿੱਥੇ ਕਿ ਬਿਲਕੁਲ ਘਰ ਵਰਗਾ ਤੁਹਾਨੂੰ ਦੇਸੀ ਘਿਓ ਦਾ ਵੈਸ਼ਨੋ ਖਾਣਾ ਮਿਲ ਜਾਂਦਾ ਹੈ ਅਤੇ ਪਟਿਆਲੇ ਦੇ ਵਿੱਚ ਹੋਰ ਵੀ ਸਥਾਨਕ ਖਾਣੇ ਜਿਸ ਤਰ੍ਹਾਂ ਜਗ੍ਹਾ ਜਗ੍ਹਾ 'ਤੇ ਤੁਸੀਂ ਦੇਖਦੇ ਹੋ ਕਿ ਜਗ੍ਹਾ ਜਗ੍ਹਾ 'ਤੇ ਕੁਲਚੇ ਵਿਕ ਰਹੇ ਹੈ ਇੱਕ ਉਹ ਢੋਲੀਆਂ ਦੇ ਵਿੱਚ ਛੋਲੇ ਲੈ ਕੇ ਉਹਦੇ ਨਾਲ ਕੁਲਚੇ ਗਰਮ ਕਰਕੇ ਦਿੰਦੇ ਹੈ ਮੱਠੀ ਛੋਲੇ ਵਿਕਦੇ ਹੈ ਇਹ ਪਟਿਆਲੇ ਦਾ ਮਸ਼ਹੂਰ ਖਾਣਾ ਅਤੇ ਮੈਨੂੰ ਬਹੁਤ ਪਸੰਦ ਹੈ